ਸਰਕਾਰੀ ਸਕੂਲ ਜਿਹੜੇ ਸਥਾਨਕ ਨੇ ਉਹਨਾਂ ਦੇ ਵਿੱਚ ਜੇ ਤਾਂ ਨਵਾਂ ਬੱਚਾ ਦਾਖਲਾ ਲੈਂਦਾ ਹੈ ਨਵਾਂ ਫਸਟ ਤੋਂ ਹੀ ਦਾਖਲਾ ਲੈਂਦਾ ਹੈ ਤਾਂ ਉਹਦੇ ਲਈ ਉਹਦਾ ਆਧਾਰ ਕਾਰਡ ਅਤੇ ਜਨਮ ਸਰਟੀਫਿਕੇਟ ਦੇਖਿਆ ਜਾਂਦਾ ਹੈ ਅਤੇ ਉਸ ਤੋਂ ਇਲਾਵਾ ਜੇ ਕਿਸੇ ਨੇ ਸਕੂਲ ਬਦਲਣਾ ਹੈ ਛੇਵੀਂ ਦੇ ਵਿੱਚ ਦਾਖਲਾ ਲੈਣਾ ਹੈ ਜਾਂ ਨੌਵੀਂ ਦੇ ਵਿੱਚ ਦਾਖਲਾ ਲੈਣਾ ਹੈ ਤਾਂ ਉਹਨੂੰ ਜਨਮ ਸਰਟੀਫਿਕੇਟ ਆਧਾਰ ਕਾਰਡ ਦੇ ਨਾਲ ਜਿਹੜਾ ਪਿਛਲਾ ਸਕੂਲ ਹੈ ਜਿਹੜਾ ਉਹਨੇ ਛੱਡਿਆ ਉਹਦਾ ਸਕੂਲ ਲਿਵਿੰਗ ਸਰਟੀਫਕੇਟ ਵੀ ਦਿਖਾਉਣਾ ਪੈਂਦਾ ਹੈ ਅਤੇ ਸਰਕਾਰੀ ਸਕੂਲਾਂ ਦੇ ਵਿੱਚ ਸਾਰਾ ਕੁਝ ਮੁਫਤ ਆ ਫੀਸ ਵੀ ਨਹੀਂ ਹੈਗੀ ਕੋਈ ਅਤੇ ਕਿਤਾਬਾਂ ਵੀ ਮੁਫਤ ਆ ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਵਿੱਚ ਮਿਡ ਡੇ ਮੀਲ ਵੀ ਜਿਹੜਾ ਬੱਚਿਆਂ ਨੂੰ ਦਿੱਤਾ ਜਾਂਦਾ ਆ